ਹਾਂਜੀ ਮੈਂ ਨਾ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਆਪਦੀ ਤਾਕਤ ਅਤੇ ਲੈ ਜੀ ਲਚਕਤਾ ਨੂੰ ਕਿਵੇਂ ਬਰਕਰਾਰ ਰੱਖਿਆ ਹੋਇਆ ਹੈਗਾ ਇਹਦੇ ਲਈ ਮੈਂ ਨਾ ਤੁਹਾਨੂੰ ਆਪਦੀਆਂ ਆਪ ਦੇ ਵਿਚਾਰ ਆ ਤੁਹਾਡੇ ਨਾਲ ਦੱਸਣਾ ਚਾਹੁੰਦਾ ਤੁਹਾਨੂੰ ਜਿਹੜਾ ਕੀ ਨਾ ਮੈਂ ਹਰ ਰੋਜ਼ ਨਾ ਤੀਹ ਮਿੰਟ ਦੀ ਕਸਰਤ ਮੈਂ ਜ਼ਰੂਰ ਕਰਦਾ ਹੈਗਾ ਜਿਹਦੇ ਵਿੱਚ ਮੇਰੀ ਹਲਕੀ ਜਿਹੀ ਦੌੜਦਾ ਵੀ ਮੈਂ ਜ਼ਰੂਰ ਜੋਗਿੰਗ ਵੀ ਮੈਂ ਕਰਦਾ ਹੈਗਾ ਸਾਈਕਲ ਵੀ ਚਲਾਉਂਦਾ ਗਾ ਅਤੇ ਹੋਰ ਐਰੋਬਿਕ ਐਕਟੀਵਿਟੀ ਵੀ ਮੇਰੀਆਂ ਹੁੰਦੀਆਂ ਹੀ ਆ ਮੋਸਟਲੀ ਮੈਂ ਕਰ ਲੈਂਦਾ ਹੁੰਦਾ ਹੈਗਾ ਤਾਂ ਜਿਹੜਾ ਮੇਰਾ ਸਰੀਰ ਆ ਤੰਦਰੁਸਤ ਰਹੇ ਇਸ ਤੋਂ ਇਲਾਵਾ ਜਿਹੜਾ ਮੈਂ ਜੇ ਲਚਕਤਾ ਨੂੰ ਵਧਾਉਣ ਦੇ ਲਈ ਮੈਂ ਯੋਗਾ ਜ਼ਰੂਰ ਕਰਦਾ ਗਾ ਭਾਵੇਂ ਮੈਂ ਹਲਕਾ ਯੋਗਾ ਕਰ ਲਵਾਂ ਪਰ ਮੈਂ ਕਰਦਾ ਜ਼ਰੂਰ ਨਾਲ ਤਾਂ ਮੇਰਾ ਸਰੀਰ ਵਧੀਆ ਰਹਿੰਦਾ ਇਹਦੇ ਨਾਲ ਨਾਲੇ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਆ ਸਟਰੈਚਿੰਗ ਵੀ ਮੈਂ ਜ਼ਰੂਰ ਕਰਦਾ ਸੌਣ ਤੋਂ ਪਹਿਲਾਂ ਅਤੇ ਉੱਠਣ ਤੋਂ ਬਾਅਦ ਜਿਹੜਾ ਸਟੈਚਿੰਗ ਕਰਨਾ ਤਾਂ ਕਹਿੰਦੇ ਬਹੁਤ ਜ਼ਿਆਦਾ ਵਧੀਆ ਹੈਗਾ ਸਾਡੀਆਂ ਮਾਸਪੇਚ ਪੇਸ਼ੀਆਂ ਨਾ ਜਿਹੜੀਆਂ ਲਚਕਦਾਰ ਹੋ ਜਾਂਦੀਆਂ ਅਤੇ ਸਾਨੂੰ ਦਰਦ ਨਹੀਂ ਗਾ ਮਿਲਦਾ ਗਾ ਠੀਕ ਹੈ ਜਿਹੜੀ ਇਹ ਤਾਕਤ ਵਾਲੀ ਸਿਖਲਾਈ ਹੈਗੀ ਜਿਹੜੀ ਮੈਨੂੰ ਆਪਣੇ ਘਰ ਵਿੱਚ ਹੀ ਵਜਨ ਉਠਾ ਕੇ ਅਤੇ ਮੈਂ ਜ਼ਰੂਰ ਕਰਦਾ ਹੁੰਦਾ ਅਤੇ ਇਹ ਸਿਖਲਾਈ ਬਹੁਤ ਛੋਟਾ ਛੋਟਾ ਵਜਨ ਹੁੰਦਾ ਹੀ ਨਹੀਂ ਆਪਾਂ ਨੂੰ ਜਿਮ ਜਾ ਕੇ ਘਰ ਵੀ ਆਪਾਂ ਕਰ ਸਕਦੇ ਹੈਗੇ ਛੋਟੀਆਂ ਛੋਟੀਆਂ ਹੁੰਦੀਆਂ ਹੈਗੀਆ ਚੀਜ਼ਾਂ ਖਿੱਚ ਖਿਚਾ ਵਾਲੀਆਂ ਘਰ ਮੇਰਾ ਉਹ ਸੰਗਲ ਜਿਹੇ ਦੇ ਨਾਲ ਡੰਡਾ ਬੰਨਿਆ ਹੋਇਆ ਉਹਦੇ ਨਾਲ ਕਰ ਲਈਦੀ ਕਈ ਵਾਰੀ ਠੀਕ ਆ ਅਤੇ ਪਰ ਜਿਹੜਾ ਕੀ ਹੈਗਾ ਇਹ ਕਰਨੀਆਂ ਸਾਨੂੰ ਚਾਹੀਦੀਆਂ ਨੇ ਇਹਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਨੇ ਸਾਡੀ ਜਿਹੜੀ ਸਿਹਤ ਸੁਧਰਦੀ ਹੈਗੀ ਸਾਡਾ ਮੂਡ ਵਧੀਆ ਬਣਿਆ ਰਹਿੰਦਾ ਗਾ ਬਿਮਾਰੀਆਂ ਤੋਂ ਬਚਦੀਆਂ ਅਤੇ ਸਾਡੀ ਉਮਰ ਹੈਗੀ ਜਿਹੜੀ ਉਹ ਬਹੁਤ ਲੰਬੀ ਹੁੰਦੀ ਹੈ ਅਤੇ ਭਾਈ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦਿੰਦਾ ਹੈਗਾ ਵੀ ਹਲਕੀ ਹਲਕੀ ਜਿਹੜੀ ਕਸਰਤ ਹੈ ਜ਼ਰੂਰ ਕਰਿਆ ਕਰੋ ਇਹਦੇ ਨਾਲ ਨਾ ਸਾਡਾ ਸਰੀਰ ਹੈਗਾ ਤਾਕਤ ਬਣੀ ਰਹਿੰਦੀ ਹੈ ਲਚਕਤਾ ਰਹਿੰਦੀ ਹੈ ਧੰਨਵਾਦ ਬਾਈ ਸਾਰਿਆਂ ਦਾ